ਨਵੇਂ ਜਨਮੇ ਬੱਚੇ ਨੂੰ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨ ਲਈ ਕੁਛ ਜ਼ਰੂਰੀ ਉਪਾਅ ਹਨ ਜੋ ਹਰ ਮਾਪਿਆਂ ਨੂੰ ਸਮਾਜਿਕ ਤੌਰ 'ਤੇ ਲੈਣੇ ਚਾਹੀਦੇ ਹਨ ਪਹਿਲਾ ਸੋਚ ਵਿਚਾਰ ਨਾਲ ਸਫਾਈ ਨਵੇਂ ਬੱਚੇ ਨੂੰ ਖੁਸ਼ਹਾਲ ਅਤੇ ਸਿਹਤ ਲਈ ਸਭ ਤੋਂ ਜ਼ਰੂਰੀ ਗੱਲ ਹੈ ਉਸ ਦੇ ਆਸ ਪਾਸ ਦਾ ਸਥਾਨ ਸਾਫ਼ ਅਤੇ ਹਾਈਜੀਨਿਕ ਰੱਖਣਾ ਘਰ ਦੀ ਸਫਾਈ ਅਤੇ ਖ਼ਾਸ ਤੌਰ 'ਤੇ ਬੱਚੇ ਦੇ ਸੌਣ ਅਤੇ ਖੇਡਣ ਵਾਲੇ ਏਰੀਆ ਨੂੰ ਸਾਫ਼ ਰੱਖਣਾ ਬੱਚਾ ਕਿਸੇ ਵੀ ਕਿਸਮ ਦੇ ਵਾਇਰਸ ਅਤੇ ਬੈਕਟੀਰੀਆ ਤੋਂ ਬਚਿਆ ਰਹਿਣਾ ਚਾਹੀਦਾ ਹੈ ਦੂਸਰਾ ਹਵਾਈ ਸਫਾਈ ਬੱਚੇ ਨੂੰ ਮਿੱਟੀ ਧੂੜ ਜਾਂ ਹੋਰ ਹਵਾ ਵਿੱਚ ਮੌਜੂਦ ਗੰਦਗੀ ਤੋਂ ਬਚਾਉਣ ਲਈ ਸਹੀ ਹਵਾ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਖਿੜਕੀਆਂ ਵਿੰਡੋ ਜਾਂ ਏਅਰ ਪਿਊਰੀਫਾਈ ਵਰਗੀਆਂ ਚੀਜ਼ਾਂ ਨਾਲ ਹਵਾ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ